ਅਸੀਂ ਆਮ ਤੌਰ 'ਤੇ ਵੇਖਦੇ ਹਾਂ ਕਿ ਵੀਹ ਕਿਲੋਮੀਟਰ ਦੀ ਦੂਰੀ ਤੋਂ ਬਾਅਦ ਭਾਸ਼ਾ ਵਿੱਚ ਬਦਲਾਵ ਆ ਜਾਂਦਾ ਹੈ ਸਾਨੂੰ ਜਿਵੇਂ ਪਤਾ ਭਾਰਤ ਦੇ ਪੱਛਮ ਵਿੱਚ ਪੰਜਾਬ ਸਥਿਤ ਹੈ ਜਿੱਥੇ ਆਮ ਤੌਰ 'ਤੇ ਪੰਜਾਬੀ ਬੋਲੀ ਜਾਂਦੀ ਹੈ ਅਤੇ ਪੂਰਬ ਵਿੱਚ ਬੰਗਾਲ ਸਥਿਤ ਹੈ ਜਿੱਥੇ ਆਮ ਤੌਰ 'ਤੇ ਬੰਗਾਲੀ ਬੋਲੀ ਜਾਂਦੀ ਹੈ ਇਸ ਲਈ ਪੰਜਾਬੀ ਬੋਡੋ ਅਤੇ ਬੰਗਾਲੀ ਵਿੱਚ ਬਸ ਇੱਕੋ ਹੀ ਸੰਬੰਧ ਨਜ਼ਰ ਆਉਂਦਾ ਹੈ ਕਿ ਇਹ ਭਾਰਤ ਦੀਆਂ ਭਾਸ਼ਾਵਾਂ ਹਨ ਧੰਨਵਾਦ